ਸਾਹਿਤ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਸਾਹਿਤ ਪ੍ਰਫੁੱਲਿਤ ਹੋ ਰਿਹਾ ਹੈ ਜਿਵੇਂ ਕਿ ਹੀਰ ਰਾਂਝਾ ਸੱਸੀ ਪੰਨੂੰ ਅਤੇ ਲੈਲਾ ਮਜਨੂੰ ਜਿਨ੍ਹਾਂ ਵਿੱਚ ਪਿਆਰ ਦੀ ਗੱਲ ਕੀਤੀ ਹੋਈ ਹੈ ਅਤੇ ਰਾਂਝੇ ਨੇ ਚੌ ਜਿੱਦਾਂ ਕਿ ਚੌਦਾਂ ਸਾਲ ਹੀਰ ਲਈ ਮੱਝੀਆਂ ਚਰਾਈਆਂ ਸੀਗੀਆਂ ਅਤੇ ਸਾਹਿਤਕਾਰ ਅੱਜ ਕੱਲ੍ਹ ਬਹੁਤ ਜ਼ਿਆਦਾ ਚੀਜ਼ਾਂ ਵਿੱਚ ਪ੍ਰਫੁੱਲਿਤ ਹੋ ਰਿਹਾ ਜਿਵੇਂ ਅੱਪਾਂ ਗੱਲ ਕਰੀਏ ਤਾਂ ਹੁਣ ਕਵਿਤਾ ਦੀ ਕਵਿਤਾ ਵਿੱਚ ਜਿਵੇਂ ਕਿ ਸੁਰਜੀਤ ਪਾਤਰ ਵੀਰ ਰਘਵੀਰ ਸਿੰਘ ਮਤਲਬ ਕਿ ਬਹੁਤ ਜ਼ਿਆਦਾ ਪ੍ਰਫੁੱਲਿਤ ਨੇ ਜੋ ਉਨ੍ਹਾਂ ਦੀਆਂ ਕਵਿਤਾਵਾਂ ਵਰਲਡ ਵਿੱਚ ਫੇਮਸ ਨੇ ਅਤੇ ਉਨ੍ਹਾਂ 'ਚ ਅੱਜ ਕੱਲ੍ਹ ਸਾਰੇ ਸੁਣਦੇ ਨੇ ਜਿਵੇਂ ਕਿ ਮੈਂ ਮੈਂ ਉਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਤੇ ਮੈਂ ਉਹਨਾਂ ਦੀਆਂ ਕਵਿਤਾਵਾਂ ਬਹੁਤ ਜ਼ਿਆਦਾ ਪੜ੍ਹਦਾ ਮੈਂ ਰੋਪੜ ਹਰਭਜਨ ਬੁੱਕ ਸਟੋਰ ਤੋਂ ਬਹੁਤ ਜ਼ਿਆਦਾ ਬੁੱਕਸ ਉਨ੍ਹਾਂ ਦੀਆਂ ਖਰੀਦਦਾ ਹਾਂ ਉਨ੍ਹਾਂ ਵਿੱਚ ਕਵਿਤਾ ਨੇ ਅਤੇ ਉਨ੍ਹਾਂ ਦਾ ਸਤ ਸਾਹਿਤ ਵਗੈਰਾ ਵੀ ਮਤਲਬ ਕਿ ਉਨ੍ਹਾਂ ਦਾ ਬਹੁਤ ਕੁਛ ਲਿਖਿਆ ਹੋਇਆ ਉਹ ਸਾਰਾ ਕੁਛ ਪੜ੍ਹਦਾ ਮੈਂ ਹੁਣ ਗੱਲ ਕਰੀਏ ਤਾਂ ਆਪਾਂ ਕ ਕਲਾਤਮਕ ਦੀ ਕਲਾਤਮਕ ਵਿੱਚ ਜਿਵੇਂ ਕਿ ਗੁਰਬਾਣੀ ਗੁਰਮੁਖੀ ਆਦਿ ਆ ਜਾਂਦੇ ਨੇ ਇਨ੍ਹਾਂ ਵਿੱਚ ਆਪਾਂ ਜੇ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਪੰਜਾਬੀ ਭਾਸ਼ਾ ਵਿੱਚ ਜਿਵੇਂ ਮਾਝੀ ਮਾਲਵਈ ਪੁਆਧੀ ਆਦਿ ਬਹੁਤ ਜ਼ਿਆਦਾ ਮਤਲਬ ਕਿ ਜ਼ਿਲ੍ਹੇ ਦੇ ਹਿਸਾਬ ਨਾਲ ਅਲੱਗ ਅਲੱਗ ਭਾਸ਼ਾਵਾਂ ਨੇ ਉਨ੍ਹਾਂ ਨੂੰ ਅਲੱਗ ਅਲੱਗ ਤਰ੍ਹਾਂ ਬੋਲਿਆ ਜਾਂਦਾ ਹੈ ਅਤੇ ਸੁਣਿਆ ਜਾਂਦਾ ਹੈ ਅਤੇ ਇੱਦਾਂ ਹੀ ਕਲਾਤਮਕ ਵੀ ਬਹੁਤ ਅੱਜ ਕੱਲ੍ਹ ਮਸ਼ਹੂਰ ਹੋ ਰਿਹਾ